ਜਿਵੇਂ ਕੋਈ ਵੀ ਫਸਲ ਵੱਡਣ ਦਾ ਟਾਇਮ ਹੁੰਦਾ ਜਾਂ ਬੀਜਣੇ ਦਾ ਟਾਇਮ ਹੁੰਦਾ ਹੈ ਤਾਂ ਰਲ਼ ਕੇ ਹੀ ਕੰਮ ਚੱਲਦਾ ਹੈ ਜਿਵੇਂ ਹੁਣ ਆਪਾਂ ਅੱਗੇ ਲਾ ਲਓ ਕਣਕ ਦੀ ਬਜਾਈ ਆਉਣੀ ਹੈ ਜਿਵੇਂ ਹੁਣ ਖੇਤ ਵਾਹੁਣੇ ਕਣਕ ਬੀਜਣੀ ਛਿੱਟਾ ਦੇ ਕੇ ਬੀਜਣਾ ਇਹ ਸਾਰਾ ਕੰਮ ਸਾਂਝਾ ਹੋ ਕੇ ਚੱਲਦਾ ਉਸ ਤੋਂ ਬਾਅਦ ਅੱਗੇ ਸਰੋਂ ਦਾ ਕੰਮ ਆ ਜਾਂਦਾ ਸਰੋਂ ਦੀ ਕਟਾਈ ਤੋਂ ਲੈ ਕੇ ਕਢਾਈ ਤੱਕ ਸਾਰੇ ਸਾਥ ਇੱਕ ਦੂਜੇ ਦਾ ਨਾਲ ਰਲ਼ ਕੇ ਹੀ ਕੰਮ ਕਰਦੇ ਹਾਂ ਤਾਂ ਕੰਮ ਹੁੰਦਾ ਵੀ ਸੁਖਾਲ਼ਾ ਹੈ ਕੰਮ ਹੁੰਦਾ ਵੀ ਕੰਮ ਵੰਡਮਾ ਹੈ ਹਰ ਕੰਮ ਉਸ ਤੋਂ ਬਾਅਦ ਅੱਗੇ ਗੰਨਾ ਲਾਉਣਾ ਹੈ ਗੰਨੇ ਦੀ ਲਵਾਈ ਦੀ ਫਸਲ ਵਿੱਚ ਅਸੀਂ ਚਾਰ ਪੰਜ ਘਰਾਂ ਦੇ ਮੁੰਡੇ ਇਕੱਠੇ ਹੋ ਕੇ ਇੱਕ ਦੂਜੇ ਦਾ ਗੰਨਾ ਵੀ ਲਵਾਉਂਦੇ ਹਨ ਅਤੇ ਵਢਾਉਣ ਵੀ ਜਾਂਦੇ ਹਾਂ ਇਸ ਲਈ ਨਾ ਸਾਨੂੰ ਸਾਥ ਮਿਲਦਾ ਰਹਿੰਦਾ ਜਿਸ ਨਾਲ ਖੇਤੀ ਕਰਨੀ ਵੀ ਸੌਖੀ ਲੱਗਦੀ ਹੈ ਤਾਂ ਸਾਨੂੰ ਕੰਮ ਵੀ ਲੇਬਰ ਤੋਂ ਕਰਾਉਣਾ ਦੁੱਖਦਾ ਨੀ ਹੈਗਾ ਕਿਉਂ ਜਦੋਂ ਕੰਮ ਹੈ ਆਪ ਕਰ ਲੈਣਾ ਸਾਨੂੰ ਲੇਬਰ ਦੀ ਜ਼ਰੂਰਤ ਨੀ ਮਹਿਸੂਸ ਹੁੰਦੀ ਹੈਗੀ